ਸਤਿ ਸ਼੍ਰੀ ਅਕਾਲ ਜੀ ਮੇਰੀ ਸਭ ਤੋਂ ਵੱਡੀ ਜੋ ਸ਼ਕਤੀ ਹੈ ਉਹ ਹੈ ਮੇਰਾ ਆਤਮ ਵਿਸ਼ਵਾਸ ਆਤਮ ਵਿਸ਼ਵਾਸ ਹੀ ਇੱਕ ਅਜਿਹੀ ਚੀਜ਼ ਹੈ ਜੋ ਕਿ ਤੁਹਾਨੂੰ ਹਰ ਕੰਮ ਕਰਨ ਦੇ ਲਈ ਕਾਬਿਲ ਬਣਾਉਂਦੀ ਹੈ ਜੇਕਰ ਤੁਹਾਡੇ ਵਿੱਚ ਆਤਮ ਵਿਸ਼ਵਾਸ ਹੋਏਗਾ ਤੁਸੀਂ ਕੋਈ ਵੀ ਕੰਮ ਆਤਮ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਉਹ ਜ਼ਰੂਰ ਪੂਰਾ ਹੁੰਦਾ ਹੈ ਮੇਰੀ ਦੂਸਰੀ ਜੋ ਸਭ ਤੋਂ ਵੱਡੀ ਸ਼ਕਤੀ ਹੈ ਉਹ ਹੈ ਮੇਰੀ ਨਿਡਰਤਾ ਮੈਂ ਬੇਖੌਫ ਹਰ ਇੱਕ ਕੰਮ ਨੂੰ ਕਰਦੀ ਹਾਂ ਮੈਂ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਚੁਣੌਤੀਆਂ ਦਾ ਡੱਟ ਕੇ ਸਾਹਮਣਾ ਕਰਦੀ ਹਾਂ ਮੇਰਾ ਪਰਿਵਾਰ ਵੀ ਮੇਰੀ ਸਭ ਤੋਂ ਵੱਡੀ ਸ਼ਕਤੀ ਹੈ ਮੇਰੇ ਪਰਿਵਾਰ ਨੇ ਹਰ ਜਗ੍ਹਾ ਮੈਨੂੰ ਸਪੋਰਟ ਕੀਤਾ ਹੈ ਮੇਰਾ ਸਹਿਯੋਗ ਦਿੱਤਾ ਹੈ ਜੇਕਰ ਪ ਪਰਿਵਾਰ ਦਾ ਸਹਿਯੋਗ ਅਤੇ ਪਿਆਰ ਤੁਹਾਡੇ ਨਾਲ ਹੋਵੇਗਾ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਜ਼ਰੂਰ ਸਫ਼ਲ ਹੋਵੋਂਗੇ ਇਸ ਤੋਂ ਇਲਾਵਾ ਜੇ ਮੈਂ ਆਪਣੀ ਸ਼ਕਤੀਆਂ ਦੀ ਗੱਲ ਕਰਾਂ ਤਾਂ ਮੇਰਾ ਦ੍ਰਿੜ ਸੰਕਲਪ ਵੀ ਮੇਰੀ ਇੱਕ ਸ਼ਕਤੀ ਹੈ ਮੈਂ ਦ੍ਰਿੜਤਾ ਦੇ ਨਾਲ ਕੋਈ ਵੀ ਕੰਮ ਕਰਦੀ ਹਾਂ ਅਤੇ ਜੇਕਰ ਮੈਂ ਕੋਈ ਕੰਮ ਨੂੰ ਮਨ ਵਿੱਚ ਕਰਨ ਦੇ ਲਈ ਥਾਣ ਲਵਾਂ ਤਾਂ ਮੈਂ ਉਹ ਕੰਮ ਜ਼ਰੂਰ ਪੂਰਾ ਕਰਦੀ ਹਾਂ ਅਤੇ ਪੂਰੀ ਦ੍ਰਿੜਤਾ ਦੇ ਨਾਲ ਕਰਦੀ ਹਾਂ ਮੇਰੀਆ ਕਮਜ਼ੋਰੀਆਂ ਦੇ ਵਿੱਚੋਂ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਜੋ ਹੈ ਉਹ ਮੈਨੂੰ ਇਹ ਲੱਗਦੀ ਹੈ ਕਿ ਕਈ ਵਾਰ ਲੋਕ ਮੇਰਾ ਦਿਲ ਬਹੁਤ ਸਾਫ਼ ਹੈ ਤਾਂ ਉਸ ਦਾ ਫਾਇਦਾ ਚੁੱਕ ਲੈਂਦੇ ਹਾਂ ਹਨ ਕਿਉਂਕਿ ਮੇਰਾ ਦਿਲ ਸਾਫ਼ ਹੈ ਤਾਂ ਮੈਨੂੰ ਸਾਹਮਣੇ ਵਾਲਾ ਵੀ ਫ਼ਦਾਂ ਦਾ ਹੀ ਲੱਗਦਾ ਹੈ ਅਤੇ ਕਈ ਵਾਰ ਲੋਕ ਇਸ ਚੀਜ਼ ਦਾ ਫਾਇਦਾ ਉਠਾਲ ਕੇ ਆਪਣਾ ਮਤਲਬ ਕੱਢ ਲੈਂਦੇ ਹਨ ਧੰਨਵਾਦ ਜੀ